ਹਾਂਜੀ ਜਦੋਂ ਮੈਂ ਆਪਣੇ ਸਕੂਲ ਲੈਵਲ 'ਤੇ ਸਟੱਡੀ ਕਰ ਰਿਹਾ ਸੀਗਾ ਉਦੋਂ ਫਿਰ ਮੈਂ ਵਿਗਿਆਨ ਅਤੇ ਮੈਥਮੈਟਿਕਸ 'ਚ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਬਿਕੋਜ਼ ਇਹ ਵਿਸ਼ੇ ਵਿਸ਼ਿਆਂ 'ਚ ਮੇਰੀ ਸ਼ੁਰੂ ਤੋਂ ਕੋਈ ਰੁਚੀ ਨਹੀਂ ਰਹੀ ਫਿਰ ਜਿਸ ਵਿਸ਼ੇ 'ਚ ਰੁਚੀ ਨਾ ਹੋਵੇ ਉਹਨੂੰ ਅਧਿਐਨ ਕਰਨ ਨੂੰ ਉਹਦੇ 'ਚ ਕਮਾਂਡ ਹਾਸਲ ਕਰਨ ਨੂੰ ਆਪਾਂ ਨੂੰ ਐਕਸਟਰਾ ਕਲਾਸ ਲੈਣੀ ਪੈਂਦੀ ਆ ਸੋ ਅਕੋਰਡਿੰਗ ਟੂ ਮੀ ਇਹ ਵਿਸ਼ੇ ਇਹ ਵਿਸ਼ੇ ਥੋੜ੍ਹੇ ਜਿਹੇ ਮੁਸ਼ਕਲ ਤਾਂ ਲੱਗ ਉਹਨੂੰ ਲੱਗਦੇ ਆ ਜਿਹਦਾ ਕੋਈ ਇੰਟਰਸਟ ਨਹੀਂ ਹੁੰਦਾ ਔਰ ਜਦੋਂ ਜਿਦ ਜਿਹੜਾ ਥੋੜ੍ਹੀ ਬਹੁਤੀ ਵੀ ਰੁਚੀ ਰੱਖਦਾ ਹੈ ਇਹਨਾਂ ਵਿਸ਼ਿਆਂ 'ਚ ਖਾਸ ਕਰਕੇ ਸਾਇੰਸ ਵਿਗਿਆਨ 'ਚ ਉਹ ਤਾਂ ਫਿਰ ਉਹਨੂੰ ਅਕੋਰਡਿੰਗ ਟੂ ਮੀ ਕੋਈ ਲੋੜ ਨਹੀਂ ਹੈਗੀ ਐਕਸਟਰਾ ਕਲਾਸ ਦੀ ਉਹ ਖੁਦ ਹੀ ਛੋਟੇ ਛੋਟੇ ਐਕਸਪੈਰੀਮੈਂਟਸ ਕਰਦਾ ਰਹਿੰਦਾ ਪ੍ਰੈਕਟੀਕਲ ਨਾਲ ਪ੍ਰੈਕਟਿਸ ਕਰਦਾ ਰਹਿੰਦਾ ਔਰ ਮੈਨੂੰ ਅਜੇ ਵੀ ਯਾਦ ਹੈ ਵੈਨ ਵੈਨ ਆਈ ਵਾਜ਼ ਇਨ ਟੈਂਥ ਕਲਾਸ ਮੈਂ ਦਸਵੀਂ ਕਲਾਸ 'ਚ ਮੈਨੂੰ ਲੋੜ ਪਈ ਸੀ ਸਾਇੰਸ ਦੀ ਕਲਾਸ ਐਕਸਟਰਾ ਕਲਾਸ ਲੈਣ ਦੀ ਬੀਕੌਜ਼ ਦਸਵੀਂ ਕਲਾਸ 'ਚ ਸਾਇੰਸ ਮੇਰਾ ਕੰਪਲਸਰੀ ਸੀਗਾ ਐਕਸਟਰਾ ਕਲਾਸ ਰੱਖਣ ਰੱਖਣ ਦੇ ਬਾਵਜੂਦ ਵੀ ਮੇਰੇ ਪ੍ਰੋਪਰ ਨੰਬਰ ਨਹੀਂ ਆ ਸਕੇ ਸੀ ਜਿੰਨੇ ਮੈਂ ਐਕਸਪੈਕਟ ਕਰ ਰਿਹਾ ਸੀਗਾ